ਮੈਂ ਰਾਜਕੁਮਾਰ ਗੁਰਦਾਸਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਹਾਂ ਜਿਵੇਂ ਕਿ ਗੱਲ ਕਰਦੇ ਹਾਂ ਟਰਾਂਸਪੋਸ਼ਨ ਦੀ ਅਸਾਨ ਬਣਾਇਆ ਕੀ ਕੀ ਸਾਨੂੰ ਫਾਇਦਾ ਮਿਲਿਆ ਹੈ ਅੱਜ ਦੇ ਯੁੱਗ ਵਿੱਚ ਜਿਵੇਂ ਕਿ ਅਸੀਂ ਆਨਲਾਈਨ ਟ੍ਰੇਨ ਟਿਕਟ ਦੀ ਬੁਕਿੰਗ ਆਪਣੇ ਫੋਨ ਰਾਹੀਂ ਹੀ ਕਰ ਸਕਦੇ ਹਾਂ ਪਹਿਲਾਂ ਸਾਨੂੰ ਕਈ ਕਈ ਘੰਟੇ ਲਾਈਨ ਵਿੱਚ ਖੜ੍ਹੇ ਹੋਣਾ ਪੈਂਦਾ ਸੀ ਫਿਰ ਜਿਵੇਂ ਕਿ ਸਾਨੂੰ ਇਕ ਦੂਜੇ ਕੋਲੋਂ ਸਟੇਸ਼ਨ 'ਤੇ ਪੁੱਛਣਾ ਪੈਂਦਾ ਸੀ ਕਿ ਕਿਹੜੀ ਟਰੇਨ ਕਿੰਨੇ ਵਜੇ ਆਉਣੀ ਹੈ ਅਤੇ ਕਿਸ ਪਲੇਟਫੋਰਮ 'ਤੇ ਆ ਰਹੀ ਹੈ ਅੱਜ ਦੇ ਯੁੱਗ ਵਿੱਚ ਸਟੇਸ਼ਨ 'ਤੇ ਆਨਲਾਈਨ ਡਿਸਪਲੇ 'ਤੇ ਸਾਨੂੰ ਪਤਾ ਚੱਲ ਜਾਂਦਾ ਹੈ ਕਿ ਫਲਾਣੀ ਟਰੇਨ ਫਲਾਣੇ ਪਲੇਟਫਾਰਮ 'ਤੇ ਆ ਰਹੀ ਹੈ ਅਤੇ ਇਸ ਐਸ ਵਨ ਜਾਂ ਐਸ ਟੂ ਡੱਬੇ ਦੀ ਟਿਕਟ ਸਾਡੇ ਕੋਲ ਹੈ ਸਾਨੂੰ ਪਤਾ ਚੱਲ ਜਾਂਦਾ ਹੈ ਇਸ ਡੱਬੇ ਦੀ ਰਜਿਸਟਰੇਸ਼ਨ ਸਾਡੀ ਸੀਟ ਬੁੱਕ ਹੋਈ ਹੈ ਤਾਂ ਅਸੀਂ ਆਪਣੀ ਸੀਟ 'ਤੇ ਜਾ ਕੇ ਆਸਾਨੀ ਨਾਲ ਸਫਰ ਕਰ ਸਕਦੇ ਹਾਂ ਪਰ ਜੇਕਰ ਟਰਾਂਸਪੋਰਟ ਦੇ ਫਾਇਦੇ ਵੇਖੀਏ ਤਾਂ ਪਹਿਲੇ ਸਾਨੂੰ ਕੋਈ ਚੀਜ਼ ਅਸੀਂ ਬੁੱਕ ਕਰਵਾਉਂਦੇ ਸਾਂ ਤਾਂ ਉਸ ਨੂੰ ਆਉਣ ਲੱਗੇ ਕਈ ਕਈ ਦਿਨ ਲੱਗ ਜਾਂਦੇ ਸਨ ਜਿਵੇਂ ਕਿ ਬਾਈ ਡਾਕ ਜਾਂ ਬਾਈ ਬੱਸ ਟਰੱਕ 'ਤੇ ਆਉਂਦੀ ਸੀ ਅੱਜ ਕਿਸੇ ਵੀ ਚੀਜ਼ ਨੂੰ ਅਸੀਂ ਆਰਡਰ ਕਰਦੇ ਹਾਂ ਟਰਾਂਸਪੋਰਟ ਦੇ ਰਾਹੀਂ ਤਾਂ ਉਹ ਚੀਜ਼ ਕੁਛ ਘੰਟਿਆਂ ਜਾਂ ਇੱਕ ਜਾਂ ਦੋ ਦਿਨ ਦੇ ਅੰਦਰ ਸਾਡੇ ਘਰ ਤੱਕ ਪਹੁੰਚਾ ਦਿੰਦੇ ਸਨ ਟਰਾਂਸਪੋਰਟ ਦੇ ਕਾਫ਼ੀ ਫਾਇਦੇ ਹਨ ਜਿਵੇਂ ਤੁਹਾਨੂੰ ਕੋਈ ਵੀ ਸਮਾਨ ਤਾਰੋ ਬਾਹਰੋਂ ਮੰਗਵਾਉਣਾ ਪੈਂਦਾ ਸੀਗਾ ਤਾਂ ਕਾਫੀ ਟਾਈਮ ਲੱਗਦਾ ਸੀ ਉਹ ਸਮਾਨ ਸਾਨੂੰ ਇੱਕ ਜਾਂ ਦੋ ਦਿਨ 'ਚ ਮਿਲ ਜਾਂਦਾ ਹੈ ਟਰਾਂਸਪੋਰਟ ਦੇ ਬਹੁਤ ਹੀ ਜ਼ਿਆਦਾ ਫਾਇਦੇ ਹਨ